ਘੋੜ ਸਵਾਰੀ ਕਰਨ ਲਈ ਬਹੁਤ ਸਾਰੀਆਂ ਵਿਧੀਆਂ ਹਨ ਘੋੜੇ ਨੂੰ ਕੰਟਰੋਲ ਕਰਨ ਲਗਾਮਾਂ ਦੀ ਵਰਤੋਂ ਬਹੁਤ ਜ਼ਰੂਰੀ ਹੈ ਇਸ ਨਾਲ ਇਹ ਕੰਡਿਆਲਾ ਵੀ ਪਾਇਆ ਜਾਂਦਾ ਏ ਰਬੜ ਧਾ ਦੇ ਤਾਰ ਦਾ ਬਣਿਆ ਹੁੰਦਾ ਇਹਤੇ ਪਰ ਮਤਲਬ ਅੰਗਰੇਜ਼ੀ ਦੇ ਅੱਖਰ ਐਚ ਦੀ ਸ਼ਕਲ ਵਰਗਾ ਹੁੰਦਾ ਮਤਲਬ ਇਹਦੇ ਵਿੱਚ ਅਸੀਂ ਆਸਾਨੀ ਨਾਲ ਸਾਨੂੰ ਬੈਠਣਾ ਸੌਖਾ ਹੋ ਜਾਂਦਾ ਅਤੇ ਜਿਹੜਾ ਕੰਡਿਆਲੇ ਦੀ ਮਦਦ ਨਾਲ ਘੋੜੇ ਦੇ ਮੂੰਹ 'ਤੇ ਹੇਠਲੇ ਦਬਾਅ ਪਾਇਆ ਜਾਂਦਾ ਜਾ ਸਕਦਾ ਮਤਲਬ ਕੰਡਿਆਲੇ ਦੇ ਨਾਲ ਲੱਗੇ ਨਾਲ ਲਗਾਮਾਂ ਨੂੰ ਕੱਸਿਆ ਜਾਂਦਾ ਹੈ ਤਾਂ ਜੋ ਮਤਲਬ ਹੱਥ ਵਿੱਚ ਫੜ ਕੇ ਮਤਲਬ ਖਿੱਚ ਲੈਂਦੇ ਤਾਂ ਜੋ ਘੋੜਾ ਉਹਨੂੰ ਕੰਟਰੋਲ ਕਰ ਸਕੇ ਉਹਦੇ ਹਿਸਾਬ ਨਾਲ ਮਤਲਬ ਘੋੜ ਸਵਾਰੀ ਲਈ ਪਹਿਲਾਂ ਉਤੇ ਕਾਠੀ ਪਾਈ ਜਾਂਦੀ ਆ ਫਿਰ ਬ ਰਕਾਬਾਂ ਵੀ ਬੰਨ ਦਿੱਤੀਆਂ ਜਾਂਦੀਆਂ ਹਨ ਕਾਠੀ 'ਤੇ ਮਤਲਬ ਬਹਿਣਾ ਸਾਣਾ ਪੈਣਾ ਕਾਠੀ ਤੋਂ ਵੀ ਵੈਸੇ ਘੋੜ ਸਵਾਰੀ ਵਿੱਚ ਕਾਫੀ ਘੋੜ ਸਵਾਰ ਕਰ ਲੈਂਦਾ ਪਰ ਜਿਹੜੀ ਕਾਠੀ ਨਾਲ ਘੋੜ ਸਵਾਰੀ ਹੁੰਦੀ ਉਹਦੇ ਨਾਲ ਬੰਦਾ ਇੱਕ ਆਰਾਮਦਾਇਕ ਅਤੇ ਘੋੜੇ ਉੱਤੇ ਸਾਹਮਣਾ ਘੋੜ ਸਵਾਰੀ ਕਰਨੀ ਸੌਖੀ ਹੋ ਜਾਂਦੀ ਹੈ ਅਤੇ ਉਹਦੇ ਨਾਲ ਜਿਹੜਾ ਰਕਾਬ 'ਤੇ ਰੱਖਦਾ ਲਗਾਮ ਫੜ ਕੇ ਅਤੇ ਮਤਲਬ ਫੜ ਕੇ ਉਹ ਮੂੰਹ ਘੋੜੇ ਦੀ ਪੂੰਛ ਵੱਲ ਹੋਣਾ ਚਾਹੀਦਾ ਮਤਲਬ ਫਿਰ ਦੂਸਰੀ ਲੱਤ ਘੋੜੇ 'ਤੇ ਘੁਮਾ ਕੇ ਤਾਂ ਉੱਪਰ ਬੈਠਿਆ ਜਾਂਦਾ ਹੈ ਘੋੜਸਵਾਰੀ ਲਈ ਮਤਲਬ ਉਹਨਾਂ ਨੂੰ ਪੂਰੇ ਜਿਹੜੇ ਉਹਦੇ ਜਿਹੜੇ ਪਰ ਇੱਕ ਬਸਤਰ ਪਹਿਨਾਏ ਮਤਲਬ ਜਿੱਦਾਂ ਆਪਾਂ ਰਕਾਬ ਹੋਏ ਉੱਪਰ ਕਾਠੀ ਹੋਈ ਪੈਰ ਰੱਖਣ ਲਈ ਪਾਏ ਜਾਂਦੇ ਹਨ ਸੀਟ ਮਤਲਬ ਸਾਰੇ ਪਹਿਨ ਕੇ ਤਾਂ ਜੋ ਘੋੜ ਸਵਾਰੀ ਵਧੀਆ ਹੁੰਦੀ ਆ ਤਰੀਕੇ ਤਾਂ ਮਤਲਬ ਇਹ ਚੱਕਰ ਆ ਵੀ ਇਹਦੇ ਨਾਲ ਆਪਣੀ ਜਿਹੜੀ ਕਸਰਤ ਵੀ ਹੋ ਜਾਂਦੀ ਹੈ ਸ਼ੌਂਕ ਵੀ ਹੁੰਦਾ ਇੱਕ ਤਰੀਕੇ ਤਾਂ ਕਾਫੀ ਪਰ ਮੇਰੇ ਨਾਲ ਆਹ ਹੈ ਵੀ ਜੇ ਪ੍ਰੋਪਰ ਲਗਾਮ ਲੱਗੀ ਹੋਵੇ ਅਤੇ ਕਾਠੀ ਪਈ ਹੋਵੇ ਮੈਂ ਉਸੇ ਤ ਵਿਧੀ ਤੁਹਾਨੂੰ ਸਮੇਂ ਵਧੀਆ ਸਮਝਦਾਰ ਉਹ ਇਹ ਮਤਲਬ ਹੁਣ ਤਾਂ ਵੀ ਪੁਰਾਣਾ ਰਿਕਾਰਡ ਹੈ ਵੀ ਤੇਰ੍ਹਵੀਂ ਮਿਲਦਾ ਮਤਲਬ ਵੀ ਇਹ ਪੁਰਾਣਾ ਘੋੜ ਸਵਾਰੀਆਂ ਵੀ ਹੁੰਦੀਆਂ ਹਨ ਤਾਂ ਜੋ ਹਰੇਕ ਨੂੰ ਘੋੜਸਵਾਰੀ ਵੀ ਸਿੱਖਣੀ ਚਾਹੀਦੀ ਹੈ ਅਤੇ ਅਲੱਗ ਅਲੱਗ ਵਿਧੀਆਂ ਵਿੱਚ ਅਪਣਾਉਣਾ ਚਾਹੀਦਾ ਹੈ